ਜੀ ਹਾਂ ਮੈਨੂੰ ਜਾਨਵਰਾਂ ਦੀ ਦੇਖਭਾਲ ਕਰਨਾ ਅਤੇ ਜਾਨਵਰਾਂ ਨੂੰ ਪਾਲਣਾ ਬਹੁਤ ਚੰਗਾ ਲੱਗਦਾ ਹੈ ਇਹਨਾਂ ਦੀ ਦੇਖਭਾਲ ਤਾਂ ਮੈਂ ਆਪ ਵੀ ਕਰ ਲੈਂਦਾ ਹਾਂ ਪਰ ਕਦੇ ਕਦੇ ਇਹਨਾਂ ਦੀ ਦੇਖਭਾਲ ਅਤੇ ਇਹਨਾਂ ਦਾ ਪਾਲਣ ਪੋਸ਼ਣ ਮੇਰੇ ਮਾਤਾ ਪਿਤਾ ਅਤੇ ਮੇਰਾ ਭਰਾ ਭੈਣ ਵੀ ਦੇਖ ਲੈਂਦੇ ਹਨ ਇਹਨਾਂ ਨੂੰ ਅਸੀਂ ਬੜੇ ਲਾਡਾਂ ਨਾਲ ਅਤੇ ਬੜੇ ਪਿਆਰ ਨਾਲ ਰੱਖਦੇ ਹਾਂ ਇਹਨਾਂ ਜਾਨਵਰਾਂ ਨਾਲ ਸਾਡੇ ਪੂਰੇ ਪਰਿਵਾਰ ਦਾ ਮੋਹ ਹੀ ਪੈ ਗਿਆ ਹੈ ਜਾਨਵਰਾਂ ਦੀ ਹਾਈਜੀਨ ਦੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਮਹੈਤ ਮਹੱਤਵਤਾ ਰੱਖੀ ਜਾਂਦੀ ਹੈ ਕਿਉਂਕਿ ਜੇ ਜਾਨਵਰ ਸਾਫ਼ ਸੁਥਰੇ ਰਹਿਣਗੇ ਤਾਂ ਉਹਨਾਂ ਦਾ ਸਰੀਰ ਵੀ ਸਾਫ਼ ਸੁਥਰਾ ਅਤੇ ਤੰਦਰੁਸਤ ਰਹੇਗਾ ਜੇ ਉਹਨਾਂ ਦਾ ਸਰੀਰ ਤੰਦਰੁਸਤ ਰਹੇਗਾ ਤਾਂ ਉਹਨਾਂ ਨੂੰ ਕੋਈ ਬਿਮਾਰੀਆਂ ਨਹੀਂ ਲੱਗ ਸਕਦੀਆਂ ਜੇਕਰ ਉਹਨਾਂ ਨੂੰ ਕੋਈ ਬਿਮਾਰੀ ਲੱਗ ਗਈ ਜਾਂ ਉਹ ਬਿਮਾਰ ਹੋ ਗਏ ਤਾਂ ਉਹਨਾਂ ਨੂੰ ਬਹੁਤ ਹੀ ਦੁੱਖ ਝੇਲਣਾ ਪਊਗਾ ਅਤੇ ਤਾਂ ਕਰ ਕੇ ਉਹਨਾਂ ਦੀ ਹਾਈਜੀਨ ਇਸ ਤਰ੍ਹਾਂ ਰੱਖੀ ਜਾ ਸਕਦੀ ਹੈ ਕਿ ਉਹਨਾਂ ਨੂੰ ਹਫ਼ਤੇ 'ਚ ਚਾਰ ਵਾਰੀ ਨਹਾਇਆ ਜਾਵੇ ਅਤੇ ਉਹਨਾਂ ਦੇ ਟੀਕਾਕਰਨ ਵੀ ਕਰਵਾਇਆ ਜਾਵੇ ਉਹਨਾਂ ਦਾ ਟੀਕਾਕਰਨ ਨਾਲ ਨਾਲ ਉਹਨਾਂ ਦੀ ਸਿਹਤ ਦੀ ਦੇਖਭਾਲ ਕੀਤੀ ਜਾਵੇ ਚੰਗਾ ਖਾਣਾ ਖਿਲਾਇਆ ਜਾਵੇ ਚੰਗਾ ਪਾਣੀ ਪਿਲਾਇਆ ਜਾਵੇ ਅਤੇ ਉਹਨਾਂ ਨੂੰ ਚੰਗੀ ਸੈਰ ਵੀ ਕਰਵਾਈ ਜਾਵੇ ਜੇ ਜਾਨਵਰ ਚੰਗੀ ਸੈਰ ਕਰਨਗੇ ਤਾਂ ਉਹਨਾਂ ਦਾ ਸਰੀਰ ਤੰਦਰੁਸਤ ਅਤੇ ਫੁਰਤੀਲਾ ਰਹੇਗਾ ਅਤੇ ਉਹਨਾਂ ਦਾ ਉਹਨਾਂ ਦੇ ਨਾਲ ਖੇਡਣ ਲਈ ਜ਼ਰੂਰ ਸਮਾਂ ਕੱਢਿਆ ਕਰੋ